ਮੈਨੂੰ ਹਾਈਕਿੰਗ ਕਰਨਾ ਬਹੁਤ ਜ਼ਿਆਦਾ ਪਸੰਦ ਹੈ ਅਤੇ ਮੈਨੂੰ ਘੁੰਮਣਾ ਬਹੁਤ ਜ਼ਿਆਦਾ ਪਸੰਦ ਹੈ ਇਸ ਕਾਰਨ ਮੈਂ ਇਸ ਸਾਲ ਹਾਈਕਿੰਗ ਕਰਨ ਕਸੋਲ ਦੇ ਜੰਗਲ ਵਿੱਚ ਗਿਆ ਸੀ ਜਿੱਥੇ ਮੈਨੂੰ ਹਾਈਕਿੰਗ ਕਰਦੇ ਹੋਏ ਬਹੁਤ ਜ਼ਿਆਦਾ ਮੁਸ਼ਕਿਲਾਂਵਾਂ ਅਤੇ ਨਾਲ ਬਹੁਤ ਜ਼ਿਆਦਾ ਖੁਸ਼ੀ ਅਤੇ ਮੈਨੂੰ ਬਹੁਤ ਜ਼ਿਆਦਾ ਮਜ਼ਾ ਵੀ ਆਇਆ ਇਸ ਕਾਰਨ ਜਦੋਂ ਮੈਂ ਹਾਈਕਿੰਗ ਕਰਨ ਜੰਗਲ ਵਿੱਚ ਗਿਆ ਸੀ ਉਸ ਦੌਰਾਨ ਮੈਂ ਕੋਈ ਵੀ ਸੇਫਟੀ ਦਾ ਧਿਆਨ ਨਹੀਂ ਰੱਖਿਆ ਜਿਸ ਕਾਰਨ ਮੈਨੂੰ ਮੈਂ ਹਾਈਕਿੰਗ ਬੂਟਸ ਵੀ ਨਹੀਂ ਸੀ ਪਾਏ ਹੋਏ ਜਿਸ ਕਾਰਨ ਮੈਨੂੰ ਬਹੁਤ ਜ਼ਿਆਦਾ ਚੜਾਈ ਚੜ੍ਹਨ ਵਿੱਚ ਬਹੁਤ ਦਿੱਕਤ ਹੋਈ ਜਿਸ ਕਾਰਨ ਮੈਨੂੰ ਬਹੁਤ ਜਲਦੀ ਸਾਹ ਚੜ ਰਿਹਾ ਸੀ ਅਤੇ ਹਾਈਕਿੰਗ ਕਰਦੇ ਹੋਏ ਮੈਨੂੰ ਬਹੁਤ ਜ਼ਿਆਦਾ ਥਕਾਵਟ ਵੀ ਹੋ ਰਹੀ ਸੀ ਉੱਥੇ ਮੈਨੂੰ ਹਾਈਕਿੰਗ ਕਰਦੇ ਹੋਏ ਮੇਰੇ ਨਾਲ ਕੋਈ ਵੀ ਨਹੀਂ ਸੀ ਮੈਂ ਇਕੱ ਇਕੱਲਾ ਸੀ ਜਿਸ ਕਾਰਨ ਮੈਂ ਅਤੇ ਉੱਥੇ ਹਾਈਕਿੰਗ ਕਰਦਾ ਹੋਇਆ ਗੁਆਚ ਵੀ ਗਿਆ ਮੈਨੂੰ ਉੱਥੇ ਬਹੁਤ ਜ਼ਿਆਦਾ ਅੰਦਰ ਜੰਗਲ ਵਿੱਚ ਚਲਿਆ ਜਾ ਚੁੱਕਿਆ ਸੀ ਜਿੱਥੇ ਮੈਨੂੰ ਪਹਾੜ ਚੜਦੇ ਚੜਦੇ ਉੱਥੇ ਮੈਂ ਗਿਰਨ ਤੋਂ ਵੀ ਕਿੰਨੀ ਵਾਰ ਬਚਿਆ ਉੱਥੇ ਮੈਂ ਪਹਾੜ ਵਿੱਚ ਬਹੁਤ ਜ਼ਿਆਦਾ ਸੱਟ ਲੱਗ ਵੀ ਸਕਦੀ ਸੀ ਜਿਸ ਕਾਰਨ ਮੈਨੂੰ ਆਪਣਾ ਇਹ ਜਿਹੀ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਮੈਨੂੰ ਹਾਈਕਿੰਗ ਕਰਨ ਵੇਲੇ ਹਮੇਸ਼ਾ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਇਸ ਕਾਰਨ ਮੈਂ ਜੋ ਇਸ ਧਿਆਨ ਨਹੀਂ ਰੱਖਿਆ ਜਿਸ ਗਲਤੀਆਂ ਕਾਰਨ ਮੈਨੂੰ ਬਹੁਤ ਜ਼ਿਆਦਾ ਜ਼ਿਆਦਾ ਚੁਣੌਤੀਆਂ ਸਾਹਮਣਾ ਵੀ ਕਰਨਾ ਪਿਆ ਜ਼ਿਆਦਾ ਅਤੇ ਮੈਨੂੰ ਇਸ ਕਾਰਨ ਕਿਉਂਕਿ ਮੈਂ ਜੇ ਆਪਣੀਆਂ ਸਾਰੀਆਂ ਚੁਣੌਤੀ ਆਪਣਾ ਹਾਈਕਿੰਗ ਬੂਟਸ ਸਭ ਕੁਝ ਆਪਣੇ ਨਾਲ ਆਪਣੇ ਫਰੈਂਡਸ ਨੂੰ ਲੈ ਕੇ ਜਾਂਦਾ ਤਾਂ ਮੈਨੂੰ ਇੰਨੀ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ ਇਸ ਕਾਰਨ ਮੈਂ ਹਮੇਸ਼ਾ ਅਤੇ ਹਰੇਕ ਅੱਗੇ ਤੋਂ ਹਮੇਸ਼ਾ ਹਾਈਕਿੰਗ ਜਾਣ ਤੋਂ ਪਹਿਲਾਂ ਆਹ ਹੁਣ ਤਾਂ ਬੂਟ ਆਪਣੇ ਫਰੈਂਡਸ ਨੂੰ ਨਾਲ ਲੈ ਕੇ ਹੀ ਜਾਂਦਾ ਹਾਂ ਉੱਥੇ ਹਾਈਕਿੰਗ ਕਰਨ ਨਾਲ ਜਦੋਂ ਮੈਂ ਗੁਆਚ ਗਿਆ ਸੀ ਤਾਂ ਮੈਨੂੰ ਉੱਥੇ ਮੈਨੂੰ ਕੋਈ ਬਹੁਤ ਮੁਸ਼ਕਿਲ ਨਾਲ ਜੰਗਲ ਵਿੱਚ ਲੱਭਣਾ ਪਿਆ ਜਾਣਾ ਪਿਆ ਲੱਭਣਾ ਮੈਨੂੰ ਬਹੁਤ ਤੁਰਨਾ ਪਿਆ ਮੈਨੂੰ ਗੂਗਲ ਉੱਤੇ ਨੈੱਟ ਵੀ ਨਹੀਂ ਸੀ ਚੱਲ ਰਿਹਾ ਜਿਸ ਕਾਰਨ ਮੈਂ ਆਪਣਾ ਵਾਪਿਸ ਆ ਸਕਾਂ ਉੱਥੇ ਮੈਂ ਪਹਾੜ ਦੇ ਉੱਪਰ ਫਸ ਚੁੱਕਿਆ ਸੀ ਜਿੱਥੇ ਮੈਨੂੰ ਉਤਰਨ ਲਈ ਮੇਰੇ ਸਰੀਰ ਵਿੱਚ ਬਹੁਤ ਐਨਰਜੀ ਵੀ ਖ਼ਤਮ ਹੋ ਚੁੱਕੀ ਸੀ ਇਸ ਲਈ ਮੈਂ ਪਹਾੜ ਤੋਂ ਉੱਤਰਨ ਸਮੇਂ ਬਹੁਤ ਜ਼ਿਆਦਾ ਥੱਕ ਚੁੱਕਿਆ ਸੀ ਜੋ ਮੇਰੀ ਹੀ ਗਲਤੀ ਸੀ ਜੋ ਮੈਂ ਆਪਣੇ ਧਿਆਨ ਨਹੀਂ ਰੱਖਿਆ ਕਿ ਜਦੋਂ ਮੈਂ ਇੰਨਾ ਪਹਾੜ ਥੋੜ੍ਹਾ ਨਹੀਂ ਚੜ੍ਹ ਸਕਦਾ ਮੈਂ ਜ਼ਿਆਦਾ ਚੜ੍ਹਿਆ ਆਉਣ ਲਈ ਆਪਣੀ ਐਨਰਜੀ ਨਹੀਂ ਬਚਾ ਸਕਿਆ ਜਿਸ ਕਾਰਨ ਮੈਨੂੰ ਬਹੁਤ ਜ਼ਿਆਦਾ ਚੁਣੌਤੀ ਹੋਈ ਜਿਸ ਕਾਰਨ ਮੈਂ ਮੈਨੂੰ ਇੱਕ ਪਹਾੜ ਚੜ੍ਹਨ ਨੂੰ ਜੋ ਸਿਰਫ਼ ਤਿੰਨ ਦੋ ਘੰਟੇ ਲੱਗੇ ਸੀ ਉਹ ਪਹਾੜ ਉਤਰਨ ਲਈ ਮੈਨੂੰ ਪੂਰੀ ਸ਼ਾਮ ਲੱਗ ਗਈ ਜਿਸ ਕਾਰਨ ਮੈਂ ਇੰਨਾ ਥੱਕ ਗਿਆ ਸੀ ਜਿਸ ਕਾ ਅਤੇ ਮੈਂ ਹੋਸਪਿਟਲ ਵੀ ਮੈਨੂੰ ਜਾਣਾ ਪਿਆ ਅਤੇ ਤਿੰਨ ਚਾਰ ਦਿਨ ਦੀ ਬੈੱਡ ਰੈਸਟ ਲੈਣੀ ਪਈ ਇਸ ਕਾਰਨ ਮੈਨੂੰ ਹਾਈਕਿੰਗ 'ਤੇ ਇਹ ਹੀ ਬਹੁਤ ਬੜੀ ਚ ਚੁਣੌਤੀ ਹੋਈ ਹਾਈਕਿੰਗ ਵਿੱਚ ਆਈ ਸੀ ਜੋ ਮੈਂ ਕੀਤੀ